ਹੈਲੋ ਹੋਰ ਬਾਈ ਜੀ ਕੀ ਹਾਲ ਨੇ ਠੀਕ ਹੋ ਹਾਂ ਠੀਕ ਹਾਂ ਠੀਕ ਠਾਕ ਵੀਰੇ ਕੱਲ੍ਹ ਕਿੱਧਰ ਚੱਲੇ ਸਕੂਟਰੀ ਚੱਕੀ ਵਿਆਹ 'ਚ ਦੇਖਿਆ ਤੁਹਾਨੂੰ ਮੈਂ

ਅੱਛਾ ਅੱਛਾ ਅੱਛਾ ਉਹ ਉਹ ਮੈਂ ਵੀ ਮੈਂ ਵੀ ਉਹ ਟ੍ਰੈਫਿਕ 'ਚ ਫਸਿਆ ਹੋਇਆ ਸੀ ਮੈਂ ਤੁਹਾਨੂੰ ਦੇਖਿਆ ਸੀ ਲੰਘੀ ਜਾਂਦੇ ਸੀਗੇ ਅਤੇ ਬਰਨਾਲਾ ਦੇ ਵਿੱਚ ਟਰੈਫਿਕ ਦਾ ਬਹੁਤ ਬੁਰਾ ਹਾਲ ਆ ਬਹੁਤ ਜ਼ਿਆਦਾ ਮਾੜਾ ਜੇ ਕੋਈ ਹਾਂਜੀ ਹਾਂ ਹਾਂ ਹਾਂ ਐਕਟੀਵਾ ਲਈ ਬੰਦੇ ਨੇ ਹਾਂਜੀ ਹਾਂ ਹਾਂ ਹਾਂ ਟਰੈਫਿਕ ਸਹੀ ਗੱਲ ਇਹ ਤਾਂ ਗੱਲ ਹੈਗੀ ਹਾਂ ਬਾਕੀ ਤਾਂ ਗਲੀਆਂ ਭੀੜੀਆਂ ਭੀੜੀਆਂ ਅਤੇ ਗੱਡੇ ਵੱਡੇ ਵੱਡੇ ਗੱਡੀਆਂ ਲੈ ਕੇ ਵਿੱਚ ਵੜ ਜਾਂਦੇ ਨੇ ਜਿਹਦੇ ਨਾਲ ਟਰੈਫਿਕ ਬਹੁਤ ਜਾਮ ਹੋ ਜਾਂਦੀ ਆ ਲੰਘਣਾ ਬਹੁਤ ਔਖਾ ਹੋ ਜਾਂਦਾ

ਹਾਂ ਹਾਂ ਸਹੀ ਗੱਲ ਆ ਤੁਸੀਂ ਛੋ ਛੋਟਾ ਜਿਹਾ ਸਮਾਨ ਲੈਣ ਲੱਗ ਜਾਓ ਘੰਟਾ ਤਾਂ ਉਂ ਹੀ ਲੱਗ ਜਾਂਦਾ ਲੰਘਦੇ ਵੜਦੇ ਨੂੰ ਹਾਂ ਹਾਂ ਹਾਂ ਬਹੁਤ ਜ਼ਿਆਦਾ ਸ ਸਦਰ ਬਾਜ਼ਾਰ 'ਚ ਦੇਖਣ ਵਾਲਾ ਇੱਕ ਦਾ ਤਿਉਹਾਰਾਂ ਦੇ ਤਿਉਹਾਰਾਂ ਦੇ ਮੌਕੇ ਚੱਲਦੇ ਨੇਗੇ ਅਤੇ ਇੱਕ ਸੜਕ ਦੇ ਉੱਤੇ ਮੋਟਰਸਾਈਕਲ ਗੱਡੀਆਂ ਲਾ ਜਾਂਦੇ ਨੇਗੇ ਅਤੇ ਬਾਅਦ 'ਚ ਰੋਡ ਜਾ ਜਾਮ ਹੋ ਜਾਂਦਾ ਬਹੁਤ ਔਖਾ ਹੁੰਦਾ ਲੱਗਣਾ ਕਰਨਾ ਬਹੁਤ ਜ਼ਿਆਦਾ ਹਾਂ ਹਾਂ ਬਸ ਬਸ ਹਾਂ ਹਾਂ ਹਾਂ ਇਹ ਵੀ ਗੱਲ ਹੈਗੀ ਹਾਂ ਹਾਂ ਹਾਂ ਸਹੀ ਗੱਲ ਆ ਹਾਂ ਇਹ ਤਾਂ ਹੈਗਾ ਬਸ ਬਸ ਇਹੀ ਗੱਲ ਹਾਂ ਰਹੀ ਗੱਲ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਬੱਚੇ ਨੂੰ ਮੇਰੇ ਬੱਚੇ ਵੀ ਜਿੱਦ ਕਰਦੇ ਨੇ ਪੋਤੇ ਜਿੱਦ ਕਰਦੇ ਨੇ ਕਿ ਅਸੀਂ ਸਕੂਟਰ ਲੈ ਕੇ ਬਾਜ਼ਾਰ ਜਾਣਾ ਅਸੀਂ ਬੱਚੇ ਨੂੰ ਭੇਜਦੇ ਨਹੀਂ ਹੈਗੇ ਜਿਵੇਂ ਚੱਲ ਤੈਨੂੰ ਅਸੀਂ ਨਾਲ ਲੈ ਜਾਂਗੇ ਤੈਨੂੰ ਇਕੱਲੇ ਨੂੰ ਨਹੀਂ ਭੇਜਣਾ ਡਰ ਲਾ ਟਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਲੋਕਾਂ ਰਾਤ ਨੂੰ ਸ਼ਾਮ ਹੁੰਦੀ ਆ ਹੈ ਕੋਈ ਖਾਧੀ ਪੀਤੀ ਵਿੱਚ ਕੋਈ ਵਿੱਚ ਮਾਰੇ ਫਿਰ ਕੌਣ ਜ਼ਿੰਮੇਵਾਰ ਹੈਗਾ

ਹਾਂ ਹਾਂ ਹਾਂ ਹਾਂ ਹਾਂ ਨਹੀਂ ਸਹੀ ਗੱਲ ਆ ਹਾਂ ਇਹ ਤਾਂ ਹੈ ਹੋਰ ਟਾਈਮ ਟਾਈਮ ਹਾਂ ਨਹੀਂ ਆਵਾਂਗੇ ਆਵਾਂਗੇ

ਹਾਂ ਹਾਂ ਨਹੀਂ ਸਹੀ ਗੱਲ ਆ ਬਸ ਕਰ ਦਿੰਦਾ ਹੁੰਦਾ ਸਹੀ ਗੱਲ ਆ ਹੈ ਨਹੀਂ ਟਰੈਫਕ ਕਿੰਨੀ ਬਾਜ਼ਾਰਾਂ ਦੇ ਵਿੱਚ ਕਿੰਨਾ ਰਸ਼ ਕਿੰਨਾ ਕੁ ਹੈ ਹਾਂ ਹਾਂ ਹਾਂ ਹਾਂ ਬਸ ਇਹੀ ਗੱਲ ਹਾਂ ਨਹੀਂ ਉਹ ਤਾਂ ਹੈ ਹਾਂ ਹਾਂ ਨਹੀਂ ਘਰ ਚੱਲੋ ਫਿਰ ਐਂ ਹੁੰਦਾ ਗਾ ਸਹੀ ਗੱਲ ਆ ਹਾਂ ਹਾਂ ਉਹੀ ਤਾਂ ਗੱਲ ਹੈ ਕਿ ਸਹੀ ਗੱਲ ਆ ਹੋਰ ਕਦੇ ਲੰਘਦੇ ਵੜਦੇ ਕੋਈ ਮਾਰ ਜਿਉ ਗੇੜਾ ਆ ਜਿਉ ਹਾਂ ਹਾਂ ਹਾਂ ਬਸ ਇਹੀ ਗੱਲ ਆ ਇਹ ਤਾਂ ਹੈ ਹਾਂ ਠੀਕ ਆ ਨਾ ਨਾ ਕੋਈ ਗੱਲ ਮੈਂ ਵੀ ਆ ਕੇ ਜਾਊਂਗਾ ਹਾਂ ਠੀਕ ਹੈ ਠੀਕ ਹੈ ਓਕੇ ਓਕੇ